ਵੈਸੇ ਤਾਂ ਮੈਨੂੰ ਲਿਖਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਜਿਸ ਦੇ ਵਿੱਚ ਮੈਂ ਜਿੱਥੇ ਵੀ ਜਾਂਦਾ ਹਾਂ ਕਿਸੇ ਪਾਸੇ ਘੁੰਮਣ ਵੀ ਜਾਂਦਾ ਹਾਂ ਉੱਥੇ ਦਾ ਮੈਂ ਆਲ਼ੇ ਦੁਆਲ਼ਾ ਆਪਣਾ ਜੇਕਰ ਮੈਨੂੰ ਕੋਈ ਵੀ ਚੀਜ਼ ਵਧੀਆ ਲੱਗਦੀ ਹੈ ਉਹ ਮੈਂ ਲਿਖਦਾ ਹਾਂ ਜਿਵੇਂ ਆਪਾਂ ਗੱਲ ਕੀਤੀ ਜਾਵੇ ਕੋਈ ਆਪਾਂ ਪੇੜ ਪੌਦਾ ਹੋ ਗਿਆ ਕੋਈ ਆਪਣਾ ਨੇਚਰ ਹੋ ਗਿਆ ਉਸ ਬਾਰੇ ਮੈਂ ਆਪਣੀ ਰੂਪ ਰੇਖਾ ਉਹਨੂੰ ਆਪਣੀ ਡਾਇਰੀ ਵਿੱਚ ਡਰਾਫਟ ਇੱਕ ਜਾਂ ਦੋ ਬਣਾਉਂਦਾ ਹਾਂ ਅਤੇ ਵੈਸੇ ਮੈਨ ਆਪਾਂ ਗੱਲ ਕੀਤੀ ਜਾਵੇ ਤਾਂ ਮੈਨੂੰ ਨਰਿੰਦਰ ਸਿੰਘ ਕਪੂਰ ਦੀ ਖਿੜਕੀਆਂ ਬੁੱਕ ਬਹੁਤ ਹੀ ਜ਼ਿਆਦਾ ਪਸੰਦ ਹੈ ਜਿਸ ਵਿੱਚ ਉਹਨਾਂ ਨੇ ਉਹਨਾਂ ਤੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੈ